ਪੰਜਾਬ ਵਿੱਚ ਆਪਣਾ ਖੇਤੀਬਾੜੀ ਆਪਣਾ ਵੀ ਖੋਜਾਂ ਦੇ ਵਿੱਚ ਬਹੁਤ ਅੱਗੇ ਮਕੀ ਜਾ ਚੁੱਕਾ ਹੈ ਆਪਣਾ ਜਿਸ ਵਿੱਚ ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਆਪਣਾ ਯੋਜਨਾ ਇਸ ਯੋਜਨਾ ਦੇ ਆਧਾਰ 'ਤੇ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਂਦੀ ਹੈ ਜੋ ਕਿ ਕਿਸਾਨਾਂ ਦੀਆਂ ਫਸਲਾਂ ਦੇ ਲਈ ਬੜੀ ਲਾਹੇਵੰਦ ਹੈ ਅਤੇ ਇਸਦੇ ਨਾਲ ਨਾਲ ਕਿਸਾਨਾਂ ਨੂੰ ਜਿਹੜੇ ਸਮਾਨ ਖਰੀਦਣ 'ਤੇ ਮਸ਼ੀਨਰੀ ਖਰੀਦਣ 'ਤੇ ਸਰਕਾਰ ਵੱਲੋਂ ਸਮੇਂ ਸਮੇਂ 'ਤੇ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਆਪਣਾ ਕਿਸਾਨਾਂ ਦੀ ਹੈਲਪ ਆਪਣਾ ਕੀਤੀ ਜਾ ਸਕੇ ਜਿਹੜੀਆਂ ਇਹ ਸਬਸਿਡੀਆਂ ਦੇ ਨਾਲ ਜ ਜਿਹੜੇ ਗਰੀਬ ਕਿਸਾਨ ਹਨ ਵੀ ਉਹਨਾਂ ਦੀਆਂ ਆਪਣਾ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ